ਹਾਂਜੀ ਮੈਂ ਦੱਸ ਸਕਦੀ ਹਾਂ ਕਿ ਘਰ ਵਿੱਚ ਖਾਣਾ ਪਕਾਉਣ ਲਈ ਵੇਲੇ ਵੀ ਜਿੱਦਾਂ ਸਿਲੰਡਰ ਦੀ ਕਿਵੇਂ ਸੁਰੱਖਿਆ ਸਾਨੂੰ ਕਰਨੀ ਚਾਹੀਦੀ ਹੈ ਵੀ ਜਿਵੇਂ ਅਸੀਂ ਪਹਿਲਾਂ ਲਾਈਟਰ ਸਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ ਨਾ ਜਦੋਂ ਗੈਸ ਅਸੀਂ ਆਨ ਕਰਨੀ ਹੈ ਇਕਦਮ ਗੈਸ ਚੱਲ ਪਵੇ ਇਹ ਇਹ ਨਹੀਂ ਕਿ ਪਹਿਲਾਂ ਗਿਆ ਆਨ ਕਰਕੇ ਰੱਖੀ ਰੱਖੋ ਅਤੇ ਲਾਈਟਰ ਤੁਸੀਂ ਲੱਭਣ ਲੱਗ ਜਾਓ ਹੈ ਨਾ ਨੁਕਸਾਨ ਹੋ ਸਕਦਾ ਆ ਫਿਰ ਤੁਸੀਂ ਜਦੋਂ ਖਾਣਾ ਤੁਹਾਡਾ ਬਣ ਗਿਆ ਅਤੇ ਤੁਸੀਂ ਪਹਿਲਾਂ ਗੈਸ ਨੂੰ ਬੰਦ ਕਰੋ ਉਹਦੇ ਬਾਅਦ ਆਪਣਾ ਜੋ ਵੀ ਆ ਉੱਤੋਂ ਬਰਤਨ ਉਠਾਓ ਉਹਨੂੰ ਹੈ ਨਾ ਅਤੇ ਈਵਨ ਅਗਰ ਜੇ ਗੈਸ ਲੀਕ ਕਰ ਰਹੀ ਤੁਹਾਨੂੰ ਸਮੈਲ ਆ ਰਹੀ ਹੈ ਤਾਂ ਤੁਸੀਂ ਬਿਲਕੁਲ ਵੀ ਕੋਈ ਸਵਿਚ ਆਨ ਨਹੀਂ ਕਰਨਾ ਅਗਰ ਆਨ ਹੈ ਤਾਂ ਉਹਨੂੰ ਆਫ ਨਹੀਂ ਕਰਨਾ ਹੈ ਨਾ ਅਤੇ ਜੇ ਆਪਾਂ ਇੱਦਾਂ ਦਾ ਧਿਆਨ ਰੱਖਾਂਗੇ ਤਾਂ ਸਾਨੂੰ ਮਤਲਬ ਠੀਕ ਰਹੇਗਾ ਨੁਕਸਾਨ ਨਹੀਂ ਕੋਈ ਹੋਵੇਗਾ ਜੇ ਘਰ ਦੇ ਅੰਦਰ ਸਾਰੀ ਗੈਸ ਭਰ ਗਈ ਹੈ ਮੰਨ ਲਓ ਗੈਸ ਲੀਕ ਹੋ ਰਹੀ ਹੈ ਅਤੇ ਤੁਹਾਨੂੰ ਨਹੀਂ ਪਤਾ ਲੱਗਿਆ ਤੁਸੀਂ ਸਾਰੇ ਘਰ ਦੇ ਮਤਲਬ ਆਪਣੇ ਬੂਹੇ ਬਾਰੀਆਂ ਖੋਲ੍ਹ ਦੇਣੀਆਂ ਆ ਤਾਂ ਜੋ ਆਪਣਾ ਸਾਰਾ ਅੰਦਰੋਂ ਹਵਾ ਨਾਲ ਸਾਰਾ ਸਾਫ਼ ਹੋ ਜਾਵੇ ਕੁਛ ਵੀ ਇਲੈਕਟਰੋਨਿਕ ਚੀਜ਼ ਨੂੰ ਨਹੀਂ ਛੇੜਣਾ ਹੈ ਨਾ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਹਨੇਰਾ ਹੈ ਤੁਸੀਂ ਟੋਰਚ ਦੀ ਵਰਤੋਂ ਕਰ ਸਕਦੇ ਹੋ ਟੋਰਚ ਵਰਤ ਕੇ ਤੁਸੀਂ ਅੱਗੋਂ ਉਹਨੂੰ ਦੇਖ ਸਕਦੇ ਹੋ ਕਿ ਕਿੱਥੇ ਲੀਕਏਜ ਹੈਗੀ ਹੈ ਤੁਸੀਂ ਉਹਨਾਂ ਨੋਬ ਨੂੰ ਪਹਿਲਾਂ ਸਿਲੰਡਰ ਤੋਂ ਬੰਦ ਕਰ ਦੇਣਾ ਹੈਗਾ ਅਤੇ ਫਿਰ ਆਪਣਾ ਬਾਰੀਆਂ ਵਗੈਰਾ ਖੋਲ੍ਹ ਦੇਣੀਆਂ ਹੈ ਨਾ